ਮੈਨੂੰ ਘਰ ਦਾ ਖਾਣਾ ਬਹੁਤ ਪਸੰਦ ਹੈ ਕਿਉਂ ਕਿਉਂ ਉਹ ਚੰਗੀ ਤਰ੍ਹਾਂ ਨਾਲ ਬਣਿਆ ਹੁੰਦਾ ਇਸ ਲਈ ਮੈਨੂੰ ਘਰ ਦਾ ਖਾਣਾ ਬਸ ਬਹੁਤ ਪਸੰਦ ਹੈ ਜੇਕਰ ਮੈਂ ਬਾਹਰ ਦੀ ਗੱਲ ਕਰਾਂ ਤਾਂ ਮੈਨੂੰ ਰੈਸਟੋਰੈਂਟ ਵਿੱਚ ਜਾ ਕੇ ਖਾਣਾ ਵੀ ਪਸੰਦ ਹੈ ਬਟ ਆਪਣੇ ਫੈਮਲੀ ਅਤੇ ਫਰੈਂਡਸ ਨਾਲ ਅਤੇ ਘਰ ਵਿੱਚ ਆਪਣੀ ਫੈਮਲੀ ਨਾਲ ਮੈਨੂੰ ਸਾਰੀ ਡਿਸ਼ਾਂ ਚੰਗੀ ਲੱਗਦੀਆਂ ਪਰ ਸਭ ਤੋਂ ਚੰਗਾ ਮੈਨੂੰ ਪੀਜ਼ਾ ਲੱਗਦਾ ਹੈ ਪੀਜ਼ਾ ਮੇਰੀ ਫੇਵਰੇਟ ਡਿਸ਼ ਹੈ ਉਹ ਮੈਂ ਆਪਣੇ ਦੋਸਤਾਂ ਨਾਲ ਕਿਤੇ ਵੀ ਜਾਂਦੀ ਹਾਂ ਤਾਂ ਜ਼ਰੂਰ ਖਾਂਦੀ ਹਾਂ ਮੈਨੂੰ ਪੀਜ਼ਾ ਬਹੁਤ ਬਹੁਤ ਪਸੰਦ ਹੈ ਅਤੇ ਮੈਂ ਉਹ ਆਪਣੇ ਫੈਵ ਫੇਵਰਟ ਰੈਸਟੋਰੈਂਟ 'ਚ ਬਹਿ ਕੇ ਡੋਮੀਨੋਜ਼ 'ਚ ਖਾਂਦੀ ਹਾਂ